ਸਾਡੇ ਖੇਤਰ ਵਿੱਚ ਚਮਕੌਰ ਸਾਹਿਬ ਤੋਂ ਸਭਾ ਆਉਂਦੀ ਹੈ ਜਿਸ ਵਿੱਚ ਕਾਫੀ ਲੋਕ ਹੁੰਦੇ ਹਨ ਅਤੇ ਆਪਣੇ ਧਾਰਮਿਕ ਮੱਥੇ ਟੇਕਦੇ ਹਨ ਅਤੇ ਸਾਡੇ ਖੇਤਰ ਵਿੱਚ ਟਿੱਬੀ ਸਾਹਿਬ ਨਾਮ ਦਾ ਗੁਰਦੁਆਰਾ ਹੈ ਜਿੱਥੇ ਮੈਂ ਹਰ ਰੋਜ਼ ਅਰਦਾਸ ਕਰਨ ਜਾਂਦਾ ਹਾਂ